ਮੈਂ ਆਪਣਾ ਫੋਟੋ ਜਾਂ ਵੀਡੀਓ ਸ਼ਾਟ ਕਰਨ ਲਈ ਇੱਕ ਚੰਗਾ ਕੈਮਰਾ ਲੱਭਦਾ ਹਾਂ ਅਤੇ ਆਪਣੇ ਮਨ ਪਸੰਦ ਕਲਰ ਮੈਚਿੰਗ ਕਰਕੇ ਕੱਪੜੇ ਪਾਉਂਦਾ ਹਾਂ ਤਾਂ ਕਿ ਮੇਰੀ ਲੁੱਕ ਵਿੱਚ ਨਿਖਾਰ ਆ ਸਕੇ ਅਤੇ ਫਿਰ ਮੈਂ ਕੋਈ ਚੰਗੀ ਜਗ੍ਹਾ ਲੱਭਦਾ ਹਾਂ ਜਿਸ ਕਰਕੇ ਬੈਕਗਰਾਊਂਡ ਨਾਲ਼ ਵੀਡੀਓ ਜਾਂ ਫੋਟੋ ਅਤੀ ਸੁੰਦਰ ਹੋ ਸਕੇ ਅਤੇ ਅੱਜ ਕੱਲ੍ਹ ਬਹੁਤ ਸਾਰੇ ਐਡੀਟਿੰਗ ਐਪਸ ਆਉਂਦੇ ਹਨ ਜਿਸ ਨਾਲ਼ ਕਿ ਫੋਟੋ ਅਤੇ ਵੀਡੀਓ ਦੀ ਬਣਾਵਟ ਬਹੁਤ ਹੀ ਸੁੰਦਰ ਅਤੇ ਅਲੌਕਿਕ ਹੋ ਜਾਂਦੀ ਹੈ ਜਿਸ ਕਾਰਨ ਲੋਕ ਉਸ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ ਇਸ ਕਰਕੇ ਮੇਰੇ ਫ਼ੋਨ ਵਿੱਚ ਬਹੁਤ ਜ਼ਿਆਦਾ ਐਪਸ ਹਨ ਜਿਸ ਨਾਲ਼ ਕਿ ਮੈਂ ਫਿਲਟਰ ਲਗਾ ਕੇ ਆਪਣੀ ਫੋਟੋ ਅਤੇ ਵੀਡੀਓ ਨੂੰ ਸੁੰਦਰ ਬਣਾ ਲੈਂਦਾ ਹਾਂ